ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਸ ਵਧੀਆ ਘਰ ਬਾਹਰ ਸਭ ਠੀਕ ਸਭ ਵਧੀਆ ਸਭ ਵਧੀਆ ਦੱਸੋ ਜੀ ਕਿ ਕੀ ਹੋ ਗਿਆ ਅੱਛਾ ਇਹ ਤਾਂ ਹੂੰ ਹੂੰ ਹੂੰ ਨਹੀਂ ਇਹ ਤਾਂ ਗਲਤ ਗੱਲ ਹੈ ਜੀ ਇੱਦਾਂ ਤਾਂ ਨਹੀਂ ਹੋਣਾ ਚਾਹੀਦਾ

ਮੇਰਾ ਵਾਲਾ ਤਾਂ ਜੀ ਗ੍ਰੀਨਲੈਂਡ ਹੈ ਗ੍ਰੀਨਲੈਂਡ ਇੱਧਰ ਆਪਣਾ ਬੀ ਆਰ ਐੱਸ ਨਗਰ ਵਾਲਾ ਹੈਗਾ ਨਾ ਹਾਂਜੀ ਜਿਹੜਾ ਬੀ ਆਰ ਐੱਸ ਨਗਰ ਵਾਲਾ ਗ੍ਰੀਨਲੈਂਡ ਹੈਗਾ ਉਧਰ ਹੈਗਾ ਜੀ ਉਧਰ ਦੇਖੋ ਤੁਹਾਨੂੰ ਸੱਚੀ ਦੱਸਾਂ ਨਾ ਉਧਰ ਨਾ ਹੀ ਲਾਇਓ ਉਹ ਵੀ ਸਕੂਲ ਨਾ ਇੰਨਾ ਹੈ ਨਹੀਂ ਮੈਂ ਜਿੰਨਾ ਸੁਣਿਆ ਸੀ ਨਾ ਜਿਹੜਾ ਮੈਂ ਸੋਚ ਕੇ ਲਾਇਆ ਸੀ ਉੰਨੀ ਐਕਸਪੇਕਟੇਸ਼ਨਸ ਪੂਰੀ ਕਰਦਾ ਨਹੀਂ ਹੈ ਇਹ ਵੀ ਸ਼ੋਸ਼ੇਬਾਜੀ ਜ਼ਿਆਦਾ ਹੈ ਅਤੇ ਪੜ੍ਹਾਉਂਦੇ ਵੀ ਘੱਟ ਹੀ ਨੇਂ ਅਤੇ ਨਾਲ ਉੱਦਾਂ ਵੀ ਸਕੂਲ ਦੀ ਰਿਪੋਟੇਸ਼ਨ ਇਸ ਟਾਈਮ ਅੱਛੀ ਨਹੀ ਚੱਲਦੀ ਬੱਚੇ ਫੁਕਰੇ ਨਿਕਲਦੇ ਪਏ ਜਿੰਨਾ ਕੁ ਸੁਣਿਆ ਮੈਂ ਤਾਂ ਆਪ ਸੋਚਦਾ ਆਪਣਿਆਂ ਦਾ ਵੀ ਸਕੂਲ ਬਦਲ ਦੇਵਾਂ ਇੱਕ ਤਾਂ ਦੇਖੋ ਜੀ ਡੀ ਪੀ ਐਸ ਸਕੂਲ ਹੈ ਆਪਣਾ ਇੱਧਰ ਹਾਂ ਫ਼ੀਸ ਉਹਦੀ ਜ਼ਿਆਦਾ ਇਹ ਹੀ ਚੱਕਰ ਹੈ ਉਹਦੀ ਫ਼ੀਸ ਜ਼ਿਆਦਾ ਅਤੇ ਉਹ ਸਪੋਰਟਸ ਦਾ ਵੀ ਘੱਟ ਹੈ ਥੋੜ੍ਹਾ ਉਹ 'ਚ ਪੜ੍ਹਾਈ ਪੜ੍ਹਾਈ ਜ਼ਿਆਦਾ ਹੈ ਅਤੇ ਉਹ ਓਲਰਾਉਂਡਰ ਨਹੀਂ ਹੁੰਦਾ ਫਿਰ ਬੱਚਾ ਪੜ੍ਹਾਈ 'ਚ ਹੀ ਰਹਿ ਜਾਂਦਾ ਜ਼ਿਆਦਾ ਉਹ ਹੀ ਗੱਲ ਹੈ ਨਾ ਹੋਰ ਕੋਈ ਸਕੂਲ ਤੁਸੀਂ ਸੋਚਿਆ ਹਾਂ ਇਹ ਇਹਨਾਂ ਦਾ ਮੈਂ ਵੀ ਸੁਣਿਆ ਹੈ ਨਾਮ ਇਹ ਤਾਂ ਵਧੀਆ ਸਕੂਲ ਨੇ ਚਲ ਬੀ ਸੀ ਐੱਮ ਦੀ ਮੈਂ ਸੁਣਿਆ ਫ਼ੀਸ ਵੀ ਠੀਕ ਠਾਕ ਜੀ ਹੈ ਜੈਨੂਅਨ ਜਿਹੀ ਆ

ਹਾਂਜੀ ਪ੍ਰਿੰਸੀਪਲ ਵੀ ਹਾਂਜੀ ਵਧੀਆਂ ਨੇ ਨਾਲ ਉਹ ਜਾਣਦੇ ਵੀ ਨੇ ਆਪਾਂ ਨੂੰ ਤਾਂ ਫਿਰ ਆਪਾਂ ਗੱਲ ਗੁੱਲ ਕਰ ਸਕਦੇ ਹਾਂ ਉਨ੍ਹਾਂ ਨਾਲ ਸੌਖੀ ਨਾਲ ਹੁਣ ਬੱਚਿਆਂ ਦਾ ਅਗਲੇ ਸਾਲ ਬੋਰਡ ਵੀ ਹੈ ਤਾਂ ਆਪਾਂ ਸਕੂਲ ਫਿਰ ਉਦੋਂ ਉਸ ਹਿਸਾਬ ਨਾਲ ਦੇਖ ਕੇ ਹੀ ਲਈਏ ਨਾ ਤਾਂ ਹੀ ਕਹਿੰਦਾ ਕਲਾਸਾਂ ਵਿੱਚ ਮਿਹਨਤ ਦੀ ਲੋੜ ਹੈ ਅਤੇ ਨਾਲ ਬੀ ਸੀ ਐੱਮ ਵਗੈਰਾ ਦੀ ਡੀ ਏ ਵੀ ਵਗੈਰਾ ਦੀ ਉਹ ਵੀ ਵਧੀਆ ਹੈ ਕੀ ਕਹਿੰਦੇ ਸਪੋਰਟਸ ਸਪੁਰਟਸ 'ਚ ਵੀ ਵਧੀਆ ਬੱਚੇ ਖੇਡਦੇ ਵੀ ਰਹਿੰਦੇ ਹੈ ਨਾਲ ਪੜ੍ਹਦੇ ਵੀ ਰਹਿੰਦੇ ਹੈ ਰਿਜ਼ਲਟ ਵੀ ਇਹਨਾਂ ਦਾ ਆਪਾਂ ਸੁਣਦੇ ਹੀ ਰਹਿੰਦੇ ਹਾਂ ਵਧੀਆ ਹਾਂ ਸਹੀ ਗੱਲ ਹੈ ਨਾਲ ਸਪੋਰਟਸ ਲੱਗ ਜਾਂਦੀ ਆ ਸਰਕਾਰੀ ਨੌਕਰੀ 'ਚ ਵੀ ਕੰਮ ਹੋ ਜਾਂਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਵੀ ਹੈ ਡੀ ਬੀ ਸੀ ਐੱਮ ਚਲੋ ਡੀ ਏ ਵੀ ਦਾ ਨਹੀਂ ਮੈਨੂੰ ਪਤਾ ਮੈਨੂੰ ਬੀ ਸੀ ਐੱਮ ਵਾਲੇ ਜਾਣਦੇ ਹੈ ਆਪਾਂ ਉਧਰ ਇੱਕ ਵਾਰ ਗੱਲ ਕਰਕੇ ਦੇਖਦੇ ਹਾਂ ਕੀ ਬਣਦਾ ਠੀਕ ਨਾਹੈ ਉਨ੍ਹਾਂ ਨੇ ਫਿਰ ਦਿੰਦਾ ਮੈਂ ਹਾਂਜੀ ਕੀ ਕਹਿ ਰਹੇ ਓ ਹਾਂਜੀ ਉਸ ਤੋਂ ਮੈਂ ਪਤਾ ਕਰ ਹੀ ਲਊਂਗਾ ਉਨ੍ਹਾਂ ਦੇ ਜਿਨ੍ਹਾਂ ਦੇ ਜਿੰਨਾ ਕੁ ਮੈਨੂੰ ਪਤਾ ਉਨ੍ਹਾਂ ਦੇ ਇੱਕ ਐਂਟਰਸ ਐਗਜ਼ਾਮ ਹੋਊਗਾ ਉਹ ਤਾਂ ਆਪਣੇ ਬੱਚੇ ਹੁਸ਼ਿਆਰ ਹੀ ਹੈ ਕਰ ਹੀ ਲੈਣਗੇ ਆਹ ਹੀ ਹੈ ਨਾ ਬਸ ਬਿਲਕੁਲ ਦੋਨਾਂ ਦਾ ਹੈਗਾ ਪੜ੍ਹਦੇ ਰਹਿਣਗੇ ਕੇ ਲੈ ਅਤੇ ਕਰ ਲੈਣਗੇ ਉਹ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਠੀਕ ਹੈ ਜੀ ਕੋਈ ਚੱਕਰ ਨਹੀਂ ਮੈਂ ਪਤਾ ਕਰਕੇ ਤੁਹਾਨੂੰ ਦੱਸ ਦਉਂਗਾ ਹੋਰ ਸੁਣਾਓ ਜੀ ਸਭ ਚੰਗਾ ਬਸ ਵਧੀਆ ਸਭ ਵਧੀਆ ਚੱਲ ਚੱਲ ਠੀਕ ਹੈ ਜੀ ਓਕੇ